ਭੰਗੜਾ ਪੰਜਾਬੀਆਂ ਦੀ ਸ਼ਾਨ ਹਨ ਭੰਗੜਾ ਬਹੁਤ ਤਰ੍ਹਾਂ ਪਾਇਆ ਜਾਂਦਾ ਹੈ ਮੁੰਡੇ ਕੁੜੀਆਂ ਅਲੱਗ ਅਲੱਗ ਉਹ ਜਾ ਮੁੰਡੇ ਉਹ ਪਾਉਂਦੇ ਹਨ ਕੁੜਤੇ ਪਜਾਮੇ ਕੋਈ ਗਲ ਦੇ ਵਿੱਚ ਉਹ ਪਾਉਂਦੇ ਆ ਕਿ ਕੈਂਠੇ ਕੁੰਡੇ ਅਤੇ ਕੋਈ ਪਾਉਂਦਾ ਹੈਗਾ ਗਲ ਦੇ ਵਿੱਚ ਉਹ ਦੂਜਾ ਇਹ ਹੱਥ ਵਿੱਚ ਡੰਡਾ ਫੜ ਕੇ ਨੱਚਦੇ ਹਨ ਕਿਤੇ ਮੁੱਛਾਂ ਨੂੰ ਵੱਟ ਚਾੜ੍ਹ ਚਾੜ੍ਹ ਕੇ ਅਤੇ ਕੁੜੀਆਂ ਜਿਹੜੀਆਂ ਉਹ ਪੰਜਾਬੀ ਸੂਟ ਪਾਉਂਦੀਆਂ ਆ ਅਤੇ ਪਰਾਂਦਾ ਪਾਉਂਦੀਆਂ ਆ ਤਾਂ ਦੂਜੀ ਪੰਜਾਬੀ ਜੁੱਤੀ ਪਾਉਂਦੀਆਂ ਆ ਤਾਂ ਗਲ ਦੇ ਵਿੱਚ ਉਹ ਵੀ ਪਾਉਂਦੀਆਂ ਜਿੱਦਾਂ ਹ ਵਾਲੇ ਹਾਰ ਹੁਰ ਜੇ ਪਾ ਲੈਂਦੀਆਂ ਤਾਂ ਬਹੁਤ ਸ ਬਹੁਤ ਸਾਰੇ ਸਟੈਪ ਹੁੰਦੇ ਹਨ ਲੁੱਡੀਆਂ ਪਾਉਂਦੇ ਹ ਹਨ ਅਤੇ ਝੂਮਰ ਪਾਉਂਦੇ ਹਨ ਅਤੇ ਗੋਲ ਗੋਲ ਘੁੰਮ ਕੇ ਨੱਚਦੇ ਹਨ ਪੈਰ ਅੱਗੇ ਪਿੱਛੇ ਕਰਕੇ ਉਹ ਸਟੈਪ ਜਿਹੇ ਕਰਦੀਆਂ ਹਨ ਕੁੜੀਆਂ ਵੀ ਮੁੰਡੇ ਵੀ ਅਤੇ ਧਮਾਲਾਂ ਪਾਉਂਦੇ ਹਨ ਅਤੇ ਬਹੁਤ ਸਾਰੇ ਉਹ ਭੰਗੜੇ ਖੁ ਆਂ ਲੁੱਡੀਆਂ ਖੁਸ਼ੀਆਂ ਮਨਾਉਂਦੇ ਹਨ ਭੰਗੜਾ ਬਹੁਤ ਬਹੁਤ ਤੁਹਾਡਾ ਧੰਨਵਾਦ